ਹੈਲੋ ਤੁਸੀਂ ਪੀਜ਼ਾ ਕਾਰਡਨ ਤੋਂ ਬੋਲ ਰਹੇ ਹੋ ਕੀ ਮੇਰੀ ਗੱਲ ਵਿੱਕੀ ਭਾਅ ਜੀ ਨਾਲ ਹੋ ਰਹੀ ਆ ਮੇ ਜੀ ਮੈਂ ਵਿੱਦਿਆ ਬੋਲ ਰਹੀ ਹਾਂ ਤੁਹਾਡੇ ਰੈਸਟੋਰੈਂਟ ਦੀ ਰੈਗੂਲਰ ਕਸਟਮਰ ਜੀ ਹਾਂਜੀ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮੈਨੂੰ ਤੁਹਾਡੇ ਰੈਸਟੋਰੈਂਟ ਦੀ ਪੀਜ਼ਾ ਬਰਗਰ ਫਰੈਂਚ ਫਰਾਈਸ ਅਤੇ ਇੱਥੋਂ ਦੀਆਂ ਕੋਲਡ ਡਰਿੰਕਸ ਬਹੁਤ ਪਸੰਦ ਨੇ ਅਤੇ ਮੈਂ ਹਮੇਸ਼ਾ ਇੱਥੇ ਆ ਕੇ ਇੰਝ ਖਾਣਾ ਪਸੰਦ ਕਰਦੀ ਹਾਂ ਅਤੇ ਬਸ ਡਿਫਰੈਂਟ ਇੰਨਾ ਹੈ ਕਿ ਅੱਜ ਮੈਂ ਆਪਣੇ ਘਰ ਵਿੱਚ ਨਹੀਂ ਹਾਂ ਦਰਅਸਲ ਮੈਂ ਗਾਂਧੀ ਪਾਰਕ ਵਿੱਚ ਆਪਣੇ ਫਰੈਂਡਸ ਨਾਲ ਫਰੈਂਡਸ ਨਾਲ ਪਾਰਟੀ ਕਰ ਰਹੀ ਹਾਂ ਮੈਂ ਉਹਨਾਂ ਨੂੰ ਟ੍ਰੀਟ ਦੇਣਾ ਚਾਹੁੰਦੀ ਹਾਂ ਕਿਉਂਕਿ ਮੈਂ ਕਲਾਸ ਵਿੱਚ ਫਸਟ ਆਈ ਹਾਂ ਸੋ ਦੈਟ ਮੈਂ ਆਪਣੇ ਫਰੈਂਡਸ ਨੂੰ ਟ੍ਰੀਟ ਦੇਣਾ ਚਾਹੁੰਦੀ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਜਿਵੇਂ ਕਿ ਮੈਨੂੰ ਤੁਹਾਡੇ ਰੈਸਟੋਰੈਂਟ ਦਾ ਇਹ ਸਭ ਖਾਣਾ ਬਹੁਤ ਪਸੰਦ ਹੈ ਅਤੇ ਉਹ ਹੀ ਪਸੰਦੀਦਾ ਚੀਜ਼ਾਂ ਮੈਂ ਆਪਣੇ ਫਰੈਂਡਸ ਨੂੰ ਵੀ ਖਵਾਵਾਂ ਅਤੇ ਇਸ ਕਰਕੇ ਤੁਸੀਂ ਮੈਨੂੰ ਮੇਰੇ ਮੌਜੂਦਾ ਪਤੇ ਨਾਲੋਂ ਜਿੱਥੇ ਇਸ ਟਾਈਮ ਮੈਂ ਹੈ ਗਾਂਧੀ ਪਾਰਕ ਵਿੱਚ ਇਹ ਔਡਰ ਪਹੁੰਚਾਉਣ ਦੀ ਕਿਰਪਾਲਤਾ ਕਰੋ ਅਤੇ ਇਹਦੀ ਕੁਆਂਟਿਟੀ ਵਧਾ ਕੇ ਤੁਸੀਂ ਮੈਨੂੰ ਗਾਂਧੀ ਪਾਰਕ ਵਿੱਚ ਇਹ ਔਡਰ ਡਿਲੀਵਰ ਕਰ ਦਓ ਅਤੇ ਮੈਨੂੰ ਇਹਦੇ ਨਾਲ ਕੁਛ ਡਿਸਪੋਜ ਡਿਸਪੋਜਬਲ ਗਲਾਸਿਸ ਪਲੇਟਸ ਅਤੇ ਸਪੂਨਸ ਪ੍ਰੋਵਾਈਡ ਕਰ ਦਿਓ ਸੋ ਦੈਟ ਕਿ ਮੈਂ ਆਪਣੇ ਫਰੈਂਡਸ ਨੂੰ ਚੰਗੀ ਤਰ੍ਹਾਂ ਇਹ ਖਾਣਾ ਸਰਵ ਕਰ ਸਕਾਂ ਥੈਂਕ ਯੂ